ਜੀ ਹਾਂ ਮੈਂ ਡਰਾਇੰਗ ਤਕਨੀਕ ਦਾ ਵਰਣਨ ਕਰ ਸਕਦਾ ਹਾਂ ਕਿਉਂਕਿ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਆਊਟਡੋਰ ਹੈਂਡਰਾਈਟਰਿੰਗ ਅਤੇ ਆਊਟਲਾਈਨ ਜਦੋਂ ਇਸ ਨੂੰ ਕੱਢਦੇ ਹਾਂ ਤਾਂ ਪਹਿਲਾਂ ਸਕੇਲ ਕੱਢਣਾ ਪੈਂਦਾ ਹੈ ਇਹ ਬਹੁਤ ਔਖਾ ਹੈ ਇਹ ਪੂਰਾ ਚੁਨੌਤੀਪੂਰਨ ਲੱਗਦਾ ਹੈ ਕਿਉਂਕਿ ਪਹਿਲਾਂ ਇਸ ਨੂੰ ਹਲਕਾ ਹਲਕਾ ਕੱਚੀ ਪੈਨਸਲ ਨਾਲ ਤਿਆਰ ਕਰਦੇ ਹਾਂ ਕਿਉਂਕਿ ਮੈਂ ਹਜੇ ਨਵਾਂ ਨਵਾਂ ਹੀ ਸਿੱਖਿਆ ਜਾਂ ਸਿੱਖਣ ਲੱਗਿਆ ਹਜੇ ਏਡੀ ਛੇਤੀ ਹੱਥ ਨਹੀਂ ਟਿਕਦਾ ਜਿਹਦੇ ਕਰਕੇ ਥੋੜ੍ਹੀ ਜਿਹੀ ਤਕਲੀਫ ਆਉਂਦੀ ਹੈ ਮਤਲਬ ਪਰੇਸ਼ਾਨੀ ਆਉਂਦੀ ਹੈ ਇਸ ਨੂੰ ਦੂਰ ਕਰਨ ਲਈ ਪਹਿਲਾਂ ਹਲਕੇ ਪੇਜ 'ਤੇ ਕੱਚੀ ਪੈਨਸ਼ਲ ਨਾਲ ਤਿਆਰ ਕਰਦੇ ਹਾਂ ਜਦੋਂ ਉਹ ਸਹੀ ਤਿਆਰ ਹੁੰਦੀ ਹੈ ਫਿਰ ਉਸ ਨੂੰ ਲਾਈਨਿੰਗ ਕੀਤਾ ਜਾਂਦਾ ਹੈ ਫੇਰ ਇਸ ਦੇ ਵਿੱਚ ਤਰੀਕੇ ਨਾਲ ਹੌਲੀ ਹੌਲੀ ਇਹ ਰੰਗ ਭਰ ਕੇ ਇਸ ਨੂੰ ਤਿਆਰ ਕਰਦੇ ਹਾਂ ਇਹਨੂੰ ਤਿਆਰ ਕਰਨਾ ਵੀ ਬਹੁਤ ਔਖਾ ਏ ਪਰ ਇਸ ਨੂੰ ਕੱਚਾ ਕਰਕੇ ਮੈਂ ਇਸ ਨੂੰ ਪਹਿਲਾਂ ਕੱਚਾ ਕਰਦਾ ਹਾਂ ਬਾਅਦ ਦੇ ਵਿੱਚ ਇਸਨੂੰ ਸਹੀ ਬਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੱਕੀ ਪੈਂਸਿਲ ਨਾਲ ਇਸਨੂੰ ਭਰਦਾ ਹਾਂ